ਪੰਜਾਬੀ ਭਾਸ਼ਾ ਇੱਕ ਰਤਨ ਹੈ ਜੋ ਪੰਜਾਬ ਦੇ ਹਿੱਸੇ ਆਇਆ ਗੁਰੂਆਂ ਪੀਰਾਂ ਕਵੀਆਂ ਲੇਖਕਾਂ ਨੇ ਜੋ ਇਸਨੂੰ ਚਾਰ ਚੰਨ ਲਗਾਏ ਹਨ ਉਹ ਵੀ ਦੁਨੀਆਂ ਦੇ ਵਿੱਚ ਇਸਨੂੰ ਰੁਸ਼ਨਾ ਰਹੇ ਹਨ ਇਹ ਭਾਸ਼ਾ ਰੌਦਰ ਹਾਸੇ ਠੱਠੇ ਆਮ ਬੋਲ ਚਾਲ ਵਿੱਚ ਹਰ ਜਗ੍ਹਾ ਤੇ ਅਲੱਗ ਅਲੱਗ ਰੂਪ ਦਿਖਾਉਂਦੀ ਹੈ ਗੁਰੂਆਂ ਦੀ ਬਾਣੀ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਅਵਤਾਰ ਪਾਸ਼ ਵਰਗੇ ਕਵੀ ਇਸ ਨੂੰ ਅਪਣਾ ਯੋਗਦਾਨ ਦੇ ਕੇ ਮਹਾਨ ਬਣੇ ਹਨ ਇਹ ਪੰਜਾਬੀ ਹੀ ਹੈ ਜਿਸਨੇ ਸਾਨੂੰ ਦੁਨੀਆ ਪੱਧਰ ਦੇ ਸਿਤਾਰੇ ਜਿਵੇਂ ਗੁਰਦਾਸ ਮਾਨ ਦਲਜੀਤ ਦੋਸਾਂਝ ਵਰਗੇ ਕਲਾਕਾਰ ਝੋਲੀ ਪਾਏ ਇਹ ਬੋਲੀ ਸੱਭਿਆਚਾਰ ਦਾ ਹੀ ਇੱਕ ਅਟੁੱਟ ਅੰਗ ਹੈ ਜਿਸ ਨੂੰ ਅਲੱਗ ਕਰਨਾ ਸੰਭਵ ਹੀ ਨਹੀਂ ਹੈ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਪੰਜਾਬੀ ਭਾਸ਼ਾ ਦਾ ਹੀ ਅਹਿਮ ਯੋਗਦਾਨ ਹੈ ਆਪ ਤੋਂ ਵੱਡੇ ਨੂੰ ਸਤਿਕਾਰ ਭਾਵ ਪ੍ਰਗਟ ਕਰਨੇ ਹੋਣ ਤਾਂ ਸਤਿ ਸ੍ਰੀ ਅਕਾਲ ਤੋਂ ਉੱਪਰ ਕੁਝ ਹੋ ਹੀ ਨਹੀਂ ਸਕਦਾ ਅਤੇ ਸੁਣਨ ਵਾਲਾ ਹੀ ਖੁਸ਼ ਹੋ ਕੇ ਅਸ਼ੀਰਵਾਦ ਦਿੰਦਾ ਹੈ ਹਰ ਮੇਲੇ ਵਿੱਚ ਪੰਜਾਬੀ ਦੇ ਹੀ ਚਰਚੇ ਹੁੰਦੇ ਹਨ ਕਿਸੇ ਪਾਸੇ ਨਕਲੀ ਨਕਲਾਂ ਕਰਦੇ ਲੋਕ ਗੀਤ ਲੋਕ ਨਾਚ ਵਰਗੇ ਪ੍ਰੋਗਰਾਮ ਇਸ ਭਾਸ਼ਾ ਦਾ ਸਨਮਾਨ ਵਧਾਉਂਦੇ ਹਨ ਵਿਆਹ ਸ਼ਾਦੀਆਂ ਵਿੱਚ ਕੁੜੀਆਂ ਮੁੰਡਿਆਂ ਦੇ ਘਰ ਪੈਂਦੀਆਂ ਬੋਲੀਆਂ ਮਾਹੀਏ ਸਿੱਠਣੀਆਂ ਨਾਨਕਾ ਮੇਲ ਦਾਦਕਾ ਮੇਲ ਦੇ ਹਾਸੇ ਠੱਠੇ ਇਸ ਪੰਜਾਬੀ ਭਾਸ਼ਾ ਵਿੱਚ ਹੀ ਐਨੇ ਸ਼ਾਨਦਾਰ ਲੱਗਦੇ ਹਨ ਤੀਆਂ ਦੇ ਤਿਉਹਾਰ ਤੇ ਕੁੜੀਆਂ ਦੇ ਗਿੱਧੇ ਵਿੱਚ ਜੇਕਰ ਇਹ ਪੰਜਾਬੀ ਬੋਲੀਆਂ ਨਾ ਹੋਣ ਤਾਂ ਸਭ ਨੂੰ ਸਭ ਕੁਛ ਫਿੱਕਾ ਫਿੱਕਾ ਹੀ ਲੱਗੇ ਫਸਲ ਦੀ ਕਟਾਈ ਤੋਂ ਬਾਅਦ ਕਿਸਾਨ ਦੀ ਖੁਸ਼ੀ ਜੋ ਕਿ ਵੈਸਾਖੀ ਦੇ ਰੂਪ ਮਨਾਈ ਜਾਂਦੀ ਹੈ ਇਹ ਵੀ ਸਨਮਾਨ ਪੰਜਾਬੀ ਨੂੰ ਹੀ ਪ੍ਰਾਪਤ ਹੈ ਹੋਰ ਕਿਸੇ ਵੀ ਭਾਸ਼ਾ ਵਿੱਚ ਪੰਜਾਬੀ ਦੀ ਤਰ੍ਹਾਂ ਫਸਲ ਦੀ ਕਟਾਈ ਨੂੰ ਨਹੀਂ ਮਨਾਇਆ ਜਾ ਸਕਦਾ ਅਤੇ ਨਾ ਹੀ ਮਨਾਇਆ ਜਾਂਦਾ ਹੈ ਜਨਮ ਤੇ ਆਉਣ ਵਾਲੀ ਖੁਸ਼ੀ ਦੇ ਪ੍ਰਗਟਾਵੇ ਤੋਂ ਲੈ ਕੇ ਮਰਨ ਦੇ ਵੈਣਾ ਤੱਕ ਪੰਜਾਬੀ ਭਾਸ਼ਾ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਂਦੀ ਅਤੇ ਸਨਮਾਨ ਦਿੰਦੀ ਆਈ ਹੈ ਅਤੇ ਹਮੇਸ਼ਾ ਦਿੰਦੀ ਹੀ ਰਹੇਗੀ